ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਆਪਣਾ ਗੁਰਚਰਨ ਸਿੰਘ ਗੱਲ ਕਰ ਰਿਹਾ ਜੀ ਤੁਸੀਂ ਤਜਿੰਦਰ ਸਿੰਘ ਬੋਲ ਰਹੇ ਹੋ ਸਰ ਮੈਨੂੰ ਨਾ ਕੱਲ੍ਹ ਲਈ ਟੈਕਸੀ ਚਾਹੀਦੀ ਸੀ ਜੋ ਕਿ ਮੈਂ ਆਪਣਾ ਚੰਡੀਗੜ੍ਹ ਘੁੰਮਣਾ ਏ ਲੋਕਲ ਇਸ ਕਰਕੇ ਤੁਸੀਂ ਮੈਨੂੰ ਪਰ ਕਿਲੋਮੀਟਰ ਹਿਸਾਬ ਤੇ ਜਾਂ ਫਿਰ ਪੂਰਾ ਹੀ ਅਜੈਸਟਮੈਂਟ ਦੱਸ ਦਿਉ ਵੀ ਕਿੰਨਾਂ ਖਰਚਾ ਆ ਜਾਵੇਗਾ ਘੁੰਮਣ ਲਈ